ਅਜੋਕੇ ਸਮੇਂ ਅੰਦਰ ਜਿਵੇਂ ਕਿ ਹਰ ਖੇਤਰ ਵਿੱਚ ਔਰਤਾਂ ਮਰਦਾਂ ਦੇ ਬਰਾਬਰ ਮੱਲਾਂ ਮਾਰ ਰਹੀਆਂ ਹਨ ਉਸੇ ਤਰ੍ਹਾਂ ਖੇਡਾਂ ਵਿੱਚ ਵੀ ਔਰਤਾਂ ਕਿਸੇ ਪੱਖੋਂ ਘੱਟ ਨਹੀਂ ਹਨ ਖੇਡਾਂ ਦਾ ਜੇ ਜ਼ਿਕਰ ਕਰੀਏ ਸਾਨੀਆ ਮਿਰਜ਼ਾ ਪੀ ਟੀ ਊਸ਼ਾ ਅਤੇ ਹੋਰ ਵੀ ਬਹੁਤ ਸਾਰੀਆਂ ਨਾਂ ਹਨ ਜਿਨ੍ਹਾਂ ਨੇ ਹ ਅ ਆਪਣੇ ਆਪਣੇ ਦੇਸ਼ ਦਾ ਨਾਂ ਉੱਚਾ ਕੀਤਾ ਅਤੇ ਜਿਹੜੀਆਂ ਵੀ ਕੋਈ ਊਣਤਾਈਆਂ ਆਉਂਦੀਆਂ ਹੋਣ ਉਹ ਹਰੇਕ ਦੇਸ਼ ਦੇ ਲੋਕਾਂ ਨੂੰ ਬਾ ਮੂਹਰੇ ਆ ਕੇ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਜੋ ਜਿਹੜੀਆਂ ਔਰਤਾਂ ਹੈ ਉਹ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਸਕਣ ਅਤੇ ਆਪਣੇ ਆਪਣੇ ਦੇਸ਼ ਦਾ ਨਾਂ ਉੱਚਾ ਕਰ ਸਕਣ